ਹੈਲੋ ਹਾਂਜੀ ਮੈਂ ਆਫਿਸ 'ਚ ਸੀਗਾ ਅੱਜ ਗਿਆ ਹੋਇਆ ਤੁਸੀਂ ਅੱਛਾ ਹਰਪ੍ਰੀਤ ਬੋਲਦਾ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਮੌਸਮ ਦਾ ਤੁਹਾਡੇ ਉਹਦਾ ਫਰਕ ਹੈ ਉਹ ਠੰਡ ਦਾ ਟਾਈਮ ਆ ਹਾਂ ਇੱਥੇ ਧੁੰਦ ਬੜੀ ਸੀ ਇੱਥੇ ਪੰਜਾਬ ਵੱਲ ਪੰਜਾਬ ਵੱਲ ਆ ਜੋ ਫਿਰ ਇੱਥੇ ਸਾਡੇ ਆਂਏ ਕਰੋ ਹੁਣ ਸਾਡੇ ਚੱਲਦਾ ਸ਼ਹੀਦੀ ਸਿੰਘ ਸਭਾ ਜੋ ਚੱਲਦੀ ਹੁੰਦੀ ਹੈ ਜੋੜਮੇਲ ਦਾ ਉਹ ਉਰੇ ਤੁਸੀਂ ਉਰੇ ਫਤਿਹਗੜ ਸਾਹਿਬ ਵਿਜੀਟ ਕਰੋ ਫਿਰ ਮੇਰੇ ਕੋਲ ਆਜੋ ਫਿਰ ਆਜੋ ਜੀ ਹਾਂ ਤੁਸੀਂ ਕੱਪੜੇ ਜਿੱਦਾਂ ਕੋਈ ਮੋਟੀ ਲੋਈ ਵਗੈਰਾ ਲੈ ਆਇਓ ਬਾਕੀ ਇੱਥੇ ਰਿਹਾਇਸ਼ ਦਾ ਪ੍ਰਬੰਧ ਮੇਰੇ ਕੋਲ ਹੈਗਾ ਫਲੈਟ ਮੈਂ ਇਸ਼ੂ ਕਰਵਾਇਆ ਹੋਇਆ ਜਿੱਥੇ ਮੈਂ ਰਹਿੰਦਾ ਅਤੇ ਉੱਥੇ ਕੈਅ ਬੰਦੇ ਹੈ ਤੁਸੀਂ ਅੱਛਾ ਅੱਛਾ ਸਾਰਾ ਪਰਿਵਾਰ ਠੀਕ ਆ ਆਜੋ ਆਜੋ ਵੈਲਕਮ ਇੱਥੇ ਦਾ ਇਤਿਹਾਸ ਤਾਂ ਸਾਰੀ ਦੁਨੀਆਂ ਦੇ ਵਿੱਚ ਕਿਤੇ ਨਹੀਂ ਲੱਭਣਾ ਸਾਰੀ ਦੁਨੀਆਂ ਤੋਂ ਛੋਟੀ ਉਮਰ ਦੀ ਕੁਰਬਾਨੀ ਜੋ ਸਿੱਖ ਇਤਿਹਾਸ ਦੇ ਵਿੱਚ ਹੋਈ ਆ ਉਹ ਇੱਥੇ ਨਾਲ ਸੰਬੰਧ ਰੱਖਦੀ ਆ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸੀ ਛੋਟੇ ਅਤੇ ਮਾਤਾ ਗੁਜਰ ਕੌਰ ਜੀ ਜਦੋਂ ਵਿਛੋੜਾ ਪੈ ਗਿਆ ਸੀ ਇੱਥੇ ਉਹਨਾਂ ਨੂੰ ਧਰਮ ਨੂੰ ਬਦਲਾਉਣ ਦੀ ਖਾਤਰ ਜੋ ਸੂਬੇ ਸੂਬਾ ਸੀ ਇੱਥੋਂ ਦਾ ਉਸ ਨੇ ਬਹੁਤ ਜ਼ੋਰ ਲਾਇਆ ਕਿ ਭਾਈ ਤੁਸੀਂ ਇਸਲਾਮ ਕਬੂਲ ਕਰੋ ਪਰ ਉਹ ਰੱਬ ਰੂਹਾਂ ਰੱਬੀ ਰੂਹਾਂ ਸੀਗੀਆ ਰੱਬ ਨਾਲ ਜੁੜੇ ਹੋਏ ਸੀਗੇ ਅਤੇ ਉਹਨਾਂ ਨੇ ਬਿਲਕੁਲ ਨਾਂਹ ਕਰ ਦਿੱਤੀ ਅਤੇ ਕਚਹਿਰੀਆਂ ਸਜਦੀਆਂ ਰਹੀਆਂ ਕਚਹਿਰੀਆਂ ਦੇ ਵਿੱਚ ਜੋ ਫਤਵਾ ਉਹਨਾਂ ਨੂੰ ਲੱਗਿਆ ਵੀ ਜਦੋਂ ਇਹ ਨਹੀਂ ਮੰਨਦੇ ਵੀ ਇਹਨਾਂ ਨੂੰ ਨੀਹਾਂ 'ਚ ਚਿਣਾ ਦਿਓ ਸੱਤ ਸਾਲ ਅਤੇ ਨੌ ਸਾਲ ਦੇ ਬੱਚੇ ਸੀਗੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਉਹਨਾਂ ਨੂੰ ਹੁਕਮ ਹੋ ਗਿਆ ਵੀ ਭਾਈ ਇਹਨਾਂ ਨੂੰ ਨੀਹਾਂ 'ਚ ਜਿੰਦੇ ਜੀਅ ਨੀਹਾਂ 'ਚ ਚਿਣਾ ਦਿਓ ਇਹ ਇਤਿਹਾਸ ਆ ਸਾਡੇ ਦਸ ਗਿਆਰ੍ਹਾਂ ਅਤੇ ਬਾਰ੍ਹਾਂ ਪੋਹ ਦਾ ਸੋਰੀ ਗਿਆਰ੍ਹਾਂ ਗਿਆਰ੍ਹਾਂ ਬਾਰ੍ਹਾਂ ਅਤੇ ਤੇਰ੍ਹਾਂ ਪੋਹ ਦਾ ਹਾਂ ਤੁਸੀਂ ਆਜੋ ਫਿਰ ਆਜੋ ਤੁਸੀਂ ਨਾ ਨੇੜੇ ਆ ਕੇ ਮੈਨੂੰ ਫੋਨ ਕਰ ਦਿਓ ਮੈਂ ਲੈ ਜਾਂਗਾ ਤੁਹਾਨੂੰ ਆ ਕੇ ਓਕੇ ਓਕੇ